ਮੈਂ ਪਟਿਆਲੇ ਜਿਲ੍ਹੇ ਦੇ ਸ਼ੁਤਰਾਣੇ ਇਲਾਕੇ ਤੋਂ ਬੋਲ ਰਹੀ ਹਾਂ ਮੈਂ ਤੁਹਾਡੇ ਡਿਲੀਵਰੀ ਬੋਆਏ ਬਾਰੇ ਕੁਛ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਮੈਂ ਦੋ ਘੰਟੇ ਪਹਿਲਾਂ ਤੁਹਾਡੀ ਕੰਪਨੀ ਤੋਂ ਆਰਡਰ ਕੀਤਾ ਸੀ ਜੋ ਕਿ ਇੱਕ ਘੰਟੇ ਵਿੱਚ ਪਹੁੰਚ ਜਾਂਦਾ ਹੈ ਭਾਵੇਂ ਕਿੰਨੀ ਕੁ ਵੀ ਟਰੈਫਿਕ ਹੋਵੇ ਕਿਉਂਕਿ ਉਹ ਸਿਰਫ਼ ਮੇਰੇ ਘਰ ਤੋਂ ਪੰਦਰਾਂ ਕਿਲੋਮੀਟਰ ਹੈ ਪਰ ਫਿਰ ਵੀ ਉਹ ਡੇਢ ਘੰਟੇ ਬਾਅਦ ਪਹੁੰਚਿਆ ਜੋ ਮੈਂ ਸਮਾਨ ਮੰਗਵਾਇਆ ਸੀ ਉਹ ਵੀ ਠੰਡਾ ਹੋ ਚੁੱਕਾ ਸੀ ਪਰ ਜਦੋਂ ਮੈਂ ਤੁਹਾਡੇ ਡਿਲੀਵਰੀ ਬੋਆਏ ਨੂੰ ਕਾਰਣ ਪੁੱਛਿਆ ਤਾਂ ਉਹ ਮੇਰੇ ਗਲ ਹੀ ਪੈ ਗਿਆ ਉਹ ਕਹਿਣ ਲੱਗਿਆ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਾਂ ਤੁਸੀਂ ਸਾਡੇ ਗਲ ਪੈ ਜਾਂਦੇ ਹੋ ਰਸਤੇ ਵਿੱਚ ਬਹੁਤ ਭੀੜ ਸੀ ਆਵਾਜਾਈ ਜ਼ਿਆਦਾ ਹੋਣ ਕਾਰਣ ਨਹੀਂ ਪਹੁੰਚ ਸਕਿਆ ਜੇ ਮੈਂ ਉਸਨੂੰ ਕਿਹਾ ਕਿ ਫਿਰ ਵੀ ਤੁਸੀਂ ਘੰਟੇ ਵਿੱਚ ਪਹੁੰਚ ਸਕਦੇ ਹੋ ਪਰ ਉਹ ਗਾਲੀ ਗਲੋਚ 'ਤੇ ਆ ਗਿਆ ਮੈਂ ਉਸ ਦਾ ਨੰਬਰ ਅਤੇ ਨਾਂ ਤੁਹਾਨੂੰ ਵਟਸਅਪ ਕਰ ਰਹੀ ਹਾਂ ਕਿਰਪਾ ਕਰਕੇ ਉਸ ਦੇ ਖਿਲਾਫ਼ ਯੋਗ ਕਾਰਵਾਈ ਕੀਤੀ ਜਾਵੇ